ਦੇਖਿਆ ਜਾਵੇ ਤਾਂ ਨਵੇਂ ਬੱਚੇ ਨੂੰ ਸਾਂਭਣ ਦੀ ਟੈਨਸ਼ਨ ਘਰ ਵਾਲਿਆਂ 'ਤੇ ਬਣੀ ਰਹਿੰਦੀ ਹੈ ਅਤੇ ਉਸਨੂੰ ਸਾਂਭਣਾ ਵੀ ਕੋਈ ਸੌਖੀ ਗੱਲ ਨਹੀਂ ਕਿਉਂਕਿ ਨਵੇਂ ਜੰਮੇ ਬੱਚੇ ਨ ਦੀ ਦੇਖ ਦੇਖਭਾਲ ਵਿੱਚ ਹਮੇਸ਼ਾ ਹੀ ਚੌਵੀ ਘੰਟੇ ਉਸਦੇ ਅੱਗੇ ਪਿੱਛੇ ਰਹਿਣਾ ਪੈਂਦਾ ਹੈ ਅਤੇ ਚੌਵੀ ਘੰਟੇ ਉਸ 'ਤੇ ਨਿਗ੍ਹਾ ਰੱਖਣੀ ਪੈਂਦੀ ਹੈ ਜਿਸ ਕਾਰਨ ਕਿ ਉਹ ਬੱਚਾ ਸੁਰੱਕਸ਼ਿਤ ਰਹੇ ਜਿਹਦੇ ਵਿੱਚ ਜਿਵੇਂ ਕਿ ਜਮ ਨਵੇਂ ਜੰਮੇ ਬੱਚੇ ਨੂੰ ਸਾਫ ਸਫਾਈ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ ਹੈ ਤਾਂ ਕਿ ਉਸ ਨੂੰ ਇਨਫੈਕਸ਼ਨ ਨਾ ਹੋਵੇ ਚਾਹੇ ਉਹ ਬਿਮਾਰ ਨਾ ਹੋਵੇ ਜਾਂ ਉਸਨੂੰ ਨਹਾਉਣ ਦੇ ਟਾਈਮ ਨਾ ਜ਼ਿਆਦਾ ਠੰਡਾ ਪਾਣੀ ਰੱਖਣਾ ਚਾਹੀਦਾ ਹੈ ਨਾ ਜ਼ਿਆਦਾ ਗਰਮ ਪਾਣੀ ਰੱਖਣਾ ਚਾਹੀਦਾ ਹੈ ਤਾਂ ਕਿ ਪਾਣੀ ਇੱਕ ਚੰਗੇ ਤਾਪਮਾਨ ਵਿੱਚ ਰਹੇ ਅਤੇ ਉਹ ਬੱਚੇ ਨੂੰ ਨਹਾਉਣ ਵਾਸਤੇ ਕੰਮ ਆਵੇ ਉਸ ਦਾ ਪਾਲਣ ਪੋਸ਼ਣ ਉਸ ਦਾ ਖਾਣ ਪਾਣ ਵੀ ਇਕਦਮ ਵਧੀਆ ਤਰੀਕੇ ਨਾਲ ਕਰਨਾ ਪੈਂਦਾ ਹੈ ਤਾਂ ਕਿ ਬੱਚੇ ਨੂੰ ਅੱਗੇ ਜਾ ਕੇ ਕੋਈ ਬਿਮਾਰੀ ਨਾ ਹੋਵੇ ਚਾਹੇ ਉਹ ਬਿਮਾਰ ਨਾ ਪੈ ਜਾਵੇ ਇਸ ਕਰਕੇ ਹੀ ਦੇਖਿਆ ਜਾਵੇ ਤਾਂ ਨਵੇਂ ਬੱਚੇ ਦਾ ਪਾਲਣ ਪੋਸ਼ਣ ਬਹੁਤ ਔਖਾ ਹੈ